ਸਾਡੇ ਪੰਜਾਬ ਦਾ ਸੱਭਿਆਚਾਰ ਹੈ ਨਾ ਜਿੱਦਾਂ ਕੁੜੀਆਂ ਇਹਦੇ 'ਚ ਹੁੰਦੀਆਂ ਜਿਹੜੀਆਂ ਆਪਾਂ ਸਾਡੀਆਂ ਨਾ ਕੁੜੀਆਂ ਜਿੱਦਾਂ ਪੰ ਪੰਜਾਬੀ ਸੂਟ ਪਾਉਣਾ ਪਸੰਦ ਕਰਦੀਆਂ ਜਿੱਦਾਂ ਪਰਾਂਦਾ ਹੈ ਨਾ ਬਾਲਾਂ 'ਚ ਪਰਾਂਦਾ ਲਾਉਣਾ ਅਤੇ ਪੰਜਾਬੀ ਜੁੱਤੀ ਹੈ ਨਾ ਪਾਉਣਾ ਪਸੰਦ ਕਰਦੀਆਂ ਅਤੇ ਅਤੇ ਮੁੰਡੇ ਜਿਹੜੇ ਗੱਭਰੂ ਜਵਾਨ ਹੁੰਦੇ ਆ ਅਤੇ ਉਹ ਕੁੜਤਾ ਪਜਾਮਾ ਹੈ ਨਾ ਅਤੇ ਪੱਗ ਬੰਨਣਾ ਅਤੇ ਗਲੇ 'ਚ ਕੈਂਠਾ ਪਾਉਣਾ ਪਸੰਦ ਕਰਦੇ ਹੈ ਨਾ ਅਤੇ ਹੈ ਨਾ ਅਤੇ ਜਿਹੜਾ ਪੰਜਾਬੀ ਸੱਭਿਆਚਾਰ ਸਾਡਾ ਬਹੁਤ ਵਧੀਆ ਏ ਬਹੁਤ ਪੁਰਾਣਾ ਸਮੇਂ ਤੋਂ ਚੱਲਿਆ ਆ ਰਿਹਾ ਅਤੇ ਬਹੁਤ ਮਸ਼ਹੂਰ ਵੀ ਹੈ ਨਾ ਅਤੇ ਜਿੱਦਾਂ ਕਿ ਅਸੀਂ ਕਹਿੰਦੇ ਕਿ ਹਾਂ ਕੁੜੀਆਂ ਜਿੱਦਾਂ ਕੁੜੀਆਂ ਜਿਹੜੇ ਗਹਿਣੇ ਹੁੰਦੇ ਹੈ ਨਾ ਜਿੱਦਾਂ ਕਿ ਲੋਂਗ ਹੋ ਗਿਆ ਹੈ ਨਾ ਸਿਰ 'ਤੇ ਸਿਰ 'ਤੇ ਜਿੱਦਾਂ ਉਹ ਪਾਉਂਦੇ ਹੁੰਦੇ ਆ ਆਪਣਾ ਟਿੱਕਾ ਟਾਈਪ ਹੈ ਨਾ ਹਾਂਜੀ ਅਤੇ ਕੰਨਾਂ 'ਚ ਬਾਲੀਆਂ ਹੈ ਨਾ ਅਤੇ ਕਈ ਤਰ੍ਹਾਂ ਦੇ ਮਤਲਬ ਕਿ ਬਹੁਤ ਸਾਰਿਆਂ ਦੇ ਉਹ ਗਹਿਣੇ ਹੁੰਦੇ ਨੇ ਬਹੁਤ ਮਤਲਬ ਕਿ ਪ੍ਰਾਂਤ ਸਮੇਂ ਤੋਂ ਚਾਲਾ ਚਲਿਆ ਆ ਰਿਹਾ ਹੈ ਨਾ ਬਹੁਤ ਵਧੀਆ ਲੱਗਦੇ ਪਾਏ ਚੰਗੇ ਸੋਹਣੇ ਵੀ ਲੱਗਦੇ ਅਤੇ ਲੱਗਦੇ ਵੀ ਹਾਂ ਸ ਪੰਜਾਬੀ ਸੱਭਿਆਚਾਰ ਨਾਲ ਜੁੜੇਵੇ ਹੈ ਨਾ ਵਧੀਆ ਲੱਗਦੇ ਜਿਹੜੇ ਵ ਵੰਡੇ ਆ ਅਤੇ ਮਤਲਬ ਇਹ ਵੀ ਇਹਨਾਂ ਦੇ ਵੀ ਬਹੁਤ ਵਧੀਆ ਮਤਲਬ ਯੋਗਦਾਰ ਹੁੰਦਾ ਕੱਪੜਿਆਂ 'ਚ ਹੈ ਨਾ ਜਿੱਦਾਂ ਮਤਲਬ ਕਿ ਕੁੜਤਾ ਪਜ਼ਾਮਾ ਪਾਉਣਾ ਹੀ ਪਸੰਦ ਕਰਦੇ ਹਨ ਕੁਝ ਹੋਰ ਮਤਲਬ ਅੱਜ ਕੱਲ ਕੋਈ ਪਾਉਂਦਾ ਨਹੀਂ ਪਰ ਅੱਜ ਕੱਲ ਸਾਡੇ ਪੰਜਾਬ 'ਚ ਜ਼ਿਆਦਾਤਰ ਕੁਰਤੇ ਪਜ਼ਾਮੇ ਪਾਉਣਾ ਪਸੰਦ ਕਰਦੇ ਕਿਤੇ ਜਾਣਾ ਗੁਰਦੁਆਰੇ ਵਗੈਰਾ ਹੈ ਨਾ ਕਿਤੇ ਵੀ ਕੋਈ ਜਗ੍ਹਾ ਜਾਣਾ ਕੁੜਤਾ ਪਜਾਮਾ ਮਤਲਬ ਬਹੁਤ ਮਤਲਬ ਛਾਅ ਜਾਂਦਾ ਮਤਲਬ ਪਾ ਕੇ ਬੰਦੇ ਕਿ ਹਾਂਜੀ ਪਾਈ ਵੀ ਚੰਗੀ ਲੱਗਦੀ ਹੈ ਨਾ ਹਾਂ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਵਧੀਆ ਏ ਮਤਲਬ ਕਿ ਐਂਡ 'ਚ ਕਹਿੰਦੇ ਕਹਿਣਾ ਚਾਹੁੰਦੇ ਕਿ ਹਾਂ ਪੰਜਾਬੀ ਸੱਭਿਆਚਾਰ ਨਾਲ ਮਤਲਬ ਬਹੁਤ ਪਿਆਰ ਹੈ ਅਤੇ ਇਹ ਬਹੁਤ ਅਮੀਰ ਹੈ ਹੈ ਨਾ